ਮੈਂ ਯੂਨੀਵਰਸਿਟੀ ਕਾਲਜ ਦੀ ਵਿਦਿਆਰਥਣ ਹਾਂ ਸਾਡੇ ਕਾਜਲ ਦੇ ਮੁੰਡਿਆਂ ਦਾ ਇੱਕ ਭੰਗੜਾ ਗਰੁੱਪ ਹੈ ਜੋ ਕਿ ਬਹੁਤ ਵਧੀਆ ਭੰਗੜਾ ਪਾਉਂਦੇ ਸਨ ਉਹਨਾਂ ਦਾ ਆਪਣਾ ਇੱਕ ਯੂਟੀਊਬ ਚੈਨਲ ਦਾ ਹੈ ਜੋ ਕਿ ਬੋਇਜ ਨੂੰ ਭੰਗੜਾ ਸਿਖਾਉਂਦੇ ਹਨ ਜੋ ਕਿ ਬਹੁਤ ਮਸ਼ਹੂਰ ਹੈ ਉਹਨਾਂ ਦਾ ਭੰਗੜਾ ਬਹੁਤ ਹੀ ਵਧੀਆ ਹੁੰਦਾ ਹੈ ਅਤੇ ਲੋਕ ਬਹੁਤ ਹੀ ਢੰਗ ਨਾਲ ਦੇਖਦੇ ਹਨ ਉਹਨਾਂ ਨੇ ਨੈਸ਼ਨਲ ਤੋਂ ਲੈ ਕੇ ਇੰਟਰਨੈਸ਼ਨਲ ਤੱਕ ਭੰਗੜੇ ਦਾ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਅੰਤਰਰਾਸ਼ਟਰੀ ਭੰਗੇ ਭੰਗੜੇ ਵਿੱਚ ਵੀ ਹਿੱਸਾ ਲਿਆ ਹੈ ਜਿਸ ਵਿੱਚ ਉਹਨਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ ਭੰਗੜਾ ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਹੀ ਪ੍ਰਸਿੱਧ ਹੈ ਅਤੇ ਪੂਰੇ ਦੇਸ਼ ਵਿੱਚ ਵੀ ਪ੍ਰਚਲਿਤ ਹੈ ਅਤੇ ਉਹ ਆਪਣਾ ਯੂਟੀਊਬ ਨੂੰ ਯੂਟੀਊਬ ਚੈਨਲ ਦੇ ਇੱਕ ਹੋਰ ਬੋਏ ਨੂੰ ਮੁਫਤ ਵਿੱਚ ਭੰਗੜਾ ਵੀ ਸਿਖਾਉਂਦੇ ਹਨ ਅਤੇ ਆਪਣੀਆਂ ਵੀਡੀਓ ਰਾਹੀਂ ਦੂਜਿਆਂ ਨੂੰ ਪ੍ਰਤੀਸ਼ਤ ਕਰਦੇ ਹਨ ਉਹ ਪੰਜਾਬੀ ਲੋਕ ਨਾਚ ਦਾ ਪ੍ਰਦਰਸ਼ਨ ਵੀ ਕਰਦੇ ਹਨ ਉਹ ਯੂਟੀਊਬ 'ਤੇ ਆਪਣੀਆਂ ਵੀਡੀਓ ਰਾਹੀਂ ਹੋਰ ਨੌਜਵਾਨਾਂ ਨੂੰ ਭੰਗੜੇ ਸਿਖਾਉਂਦੇ ਹਨ ਅਤੇ ਆਪਣੇ ਆਪਣੇ ਮਨ ਦਾ ਪ੍ਰਚਲਨ ਕਰਦੇ ਹਨ ਭੰਗੜਾ ਬਹੁਤ ਹੀ ਮਸ਼ਹੂਰ ਨਾਚ ਹੈ ਜੋ ਕਿ ਅੱਜ ਕੱਲ੍ਹ ਬਹੁਤ ਹੀ ਨੌਜਵਾਨ ਪਾਉਂਦੇ ਹਨ ਅਤੇ ਬਹੁਤ ਸਾਰੇ ਇਸ ਭੰਗੜੇ ਦਾ ਕਾਰਨ ਬਣਦੇ ਹਨ ਭੰਗੜਾ ਆਮ ਤੌਰ 'ਤੇ ਆਮ ਵਾਲੀ ਗੱਲ ਨਹੀਂ ਹੈ ਬਲਕਿ ਇਹ ਬਹੁਤ ਹੀ ਖਾਸ ਵਾਲੀ ਗੱਲ ਹੈ ਭੰਗੜਾ ਆਮ ਲੋਕਾਂ ਕਰਕੇ ਆਮ ਲਈ ਹੀ ਪਾਇਆ ਜਾਂਦਾ ਇਹ ਬਹੁਤ ਹੀ ਖਾਸ ਜਗ੍ਹਾ 'ਤੇ ਪ੍ਰਸਿੱਧ ਲੋਕਾਂ ਵਿੱਚ ਹੀ ਪਾਇਆ ਜਾਂਦਾ ਹੈ ਭੰਗੜਾ ਬਹੁਤ ਹੀ ਮਸ਼ਹੂਰ ਦੇਹੀ ਅਧਿ ਕਾਰਾ ਹੈ ਜੋ ਕਿ ਹਮੇਸ਼ਾ ਲਈ ਪੰਜਾਬ ਵਿੱਚ ਚੱਲਦਾ ਰਹੇਗਾ ਅਤੇ ਆਉਣ ਵਾਲੀ ਪੀੜ੍ਹੀ ਵੀ ਜੋ ਕਿ ਭੰਗੜੇ ਵਿੱਚ ਬਹੁਤਾ ਪ੍ਰਸਿੱਧ ਹੈ ਇਸ ਕਰਕੇ ਆਪਾਂ ਭੰਗੜਾ ਬਹੁਤ ਹੀ ਮਸ਼ਹੂਰ ਲੋਕ ਨਾਚ ਹੈ